ਸਤਿ ਸ਼੍ਰੀ ਅਕਾਲ ਸਾਡੇ ਖੇਤਰ ਵਿੱਚ ਇੱਕ ਤਾਂ ਸੂਟਾਂ ਦੀ ਬਹੁਤ ਜ਼ਿਆਦਾ ਡਿਮਾਂਡ ਹੈ ਲੋ ਔਰਤਾਂ ਅੱਜ ਕੱਲ੍ਹ ਨਵੇਂ ਨਵੇਂ ਡਿਜ਼ਾਈਨ ਦੇ ਸੂਟ ਬਣਾਉਣਾ ਪਸੰਦ ਕਰਦੀਆਂ ਹਨ ਅਤੇ ਉਹਨਾਂ 'ਤੇ ਉਹ ਵਰਕ ਵੀ ਕਰਵਾਉਣਾ ਚਾਹੁੰਦੀਆਂ ਹਨ ਕਈ ਔਰਤਾਂ ਆਪਣੇ ਸੂਟ ਨੂੰ ਪੇਂਟ ਵੀ ਕਰਵਾਉਂਦੀਆਂ ਹਨ ਮੈਂ ਆਪਣੇ ਖੇਤਰ ਵਿੱਚ ਇੱਕ ਤਾਂ ਬੁਟੀਕ ਖੋਲਣਾ ਚਾਹਵਾਂਗੀ ਅਤੇ ਦੂਜਾ ਬਿਊਟੀ ਪਾਰਲਰ ਕਿਉਂਕਿ ਅੱਜ ਕੱਲ੍ਹ ਲੋਕ ਔਰਤਾਂ ਨਿੱਕੇ ਮੋਟੇ ਫੰਕਸ਼ਨ 'ਤੇ ਜਾਣ ਲਈ ਵੀ ਬਿਊਟੀ ਪਾਰਲਰ ਵਿੱਚੋਂ ਤਿਆਰ ਹੋ ਕੇ ਜਾਂਦੀਆਂ ਹਨ ਉਹ ਆਪਣੇ ਹੇਅਰਸ ਨੂੰ ਨਵੇਂ ਨਵੇਂ ਢੰਗ ਨਾਲ ਕਟਿੰਗ ਕਰਵਾਉਂਦੀਆਂ ਹਨ ਅੱਜ ਕੱਲ੍ਹ ਔਰਤਾਂ ਫ਼ੇਸ ਨੂੰ ਸਾਫ ਸੁਥਰਾ ਰੱਖਣ ਲਈ ਬਹੁਤ ਸਾਰੀਆਂ ਤਕਨੀਕਾਂ ਦੀ ਵਰਤੋਂ ਕਰਦੀਆਂ ਹਨ ਉਹ ਫੇਸ਼ੀਅਲ ਵਗੈਰਾ ਕਰਵਾਉਂਦੀਆਂ ਹਨ ਬਲੀਚ ਕਰਵਾਉਂਦੀਆਂ ਹਨ ਜਿਹਨਾਂ ਨਾਲ ਉਹਨਾਂ ਦਾ ਚਿਹਰਾ ਹੋਰ ਵੀ ਖੂਬਸੂਰਤ ਨਜ਼ਰ ਆਵੇ ਹਰ ਔਰਤ ਚਾਹੁੰਦੀ ਹੈ ਕਿ ਉਹ ਦੂਜੀ ਔਰਤ ਤੋਂ ਵੀ ਸੋਹਣੀ ਲੱਗੇ ਮੈਂ ਆਪਣੇ ਖੇਤਰ ਵਿੱਚ ਇੱਕ ਬੁਟੀਕ ਖੋਲ੍ਹਣਾ ਚਾਹਵਾਂਗੀ ਕਿਉਂਕਿ ਅੱਜ ਕੱਲ੍ਹ ਔਰਤਾਂ ਨਵੇਂ ਨਵੇਂ ਸੂਟ ਪਾਉਂਦੀਆਂ ਅਤੇ ਨਵੇਂ ਨਵੇਂ ਡਿਜ਼ਾਇਨ ਪਵਾਉਣ ਦੀਆਂ ਬਹੁਤ ਸ਼ੌਕੀਨ ਹਨ ਉਹਨਾਂ ਨੂੰ ਐਵੇਂ ਹੁੰਦਾ ਹੈ ਕਿ ਮੇਰਾ ਸੂਟ ਦੂਜੀ ਔਰਤ ਤੋਂ ਵੀ ਸੋਹਣਾ ਬਣਿਆ ਹੋਵੇ ਉਹਦੇ 'ਤੇ ਉਹਦੇ ਤੋਂ ਵੀ ਵੱਧ ਸੋਹਣੀ ਕਢਾਈ ਕੀਤੀ ਹੋਵੇ ਇਸ ਲਈ ਮੈਂ ਆਪਣੇ ਖੇਤਰ ਵਿੱਚ ਬਟੀਕ ਖੋਲ੍ਹਣਾ ਚਾਹਵਾਂਗੀ ਤਾਂ ਬੁਟੀਕ ਵਿੱਚ ਮੈਂ ਨਵੇਂ ਨਵੇਂ ਲੋਕਾਂ ਨੂੰ ਮਿਲਾਂਗੀ ਮੈਨੂੰ ਅਲੱਗ ਅਲੱਗ ਕੱਪੜਿਆਂ ਬਾਰੇ ਜਾਣਕਾਰੀ ਮਿਲੇਗੀ ਅਤੇ ਮੈਂ ਜਿਸ ਨਾਲ ਆਪਦਾ ਛੋਟਾ ਜਿਹਾ ਕਾਰੋਬਾਰ ਸ਼ੁਰੂ ਕਰ ਸਕਾਂਗੀ ਜਿਸ ਨਾਲ ਮੇਰੀਆਂ ਬਹੁਤ ਸਾਰੀਆਂ ਪਰੇਸ਼ਾਨੀਆਂ ਵੀ ਦੂਰ ਹੋ ਜਾਣਗੀਆਂ ਜੇ ਮੈਨੂੰ ਕੱਪੜੇ ਸਟਿੱਚ ਕਰਨ ਵਿੱਚ ਬਹੁਤ ਜ਼ਿਆਦਾ ਸ਼ੌਂਕ ਹੈ ਤਾਂ ਮੈਨੂੰ ਉਹ ਮੇਰੇ ਸ਼ੌਂਕ ਨੂੰ ਵਢਾਵਾ ਦੇਣਾ ਚਾਹੀਦਾ ਹੈ ਕਿਉਂਕਿ ਜਿਹੜੀ ਚੀਜ਼ ਵਿੱਚ ਆਪਾਂ ਨੂੰ ਜ਼ਿਆਦਾ ਦਿਲਚਸਪੀ ਹੁੰਦੀ ਹੈ ਉਹ ਕੰਮ ਆਪਾਂ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹਾਂ ਜੇਕਰ ਮੈਂ ਮੇਰੇ ਖੇਤਰ ਵਿੱਚ ਇੱਕ ਬੁਟੀਕ ਖੋਲ੍ਹਾਂਗੀ ਤਾਂ ਮੇਰੇ ਕੋਲ ਚਾਰ ਜਾਣੀਆਂ ਚਾਰ ਔਰਤਾਂ ਹੋਰ ਲੱਗ ਜਾਣਗੀਆਂ ਅਤੇ ਉਹ ਵੀ ਕੱਪੜੇ ਸਿਉਣਾ ਸਿੱਖ ਜਾਣਗੀਆਂ ਤਾਂ ਉਹਨਾਂ ਨੂੰ ਵੀ ਫਾਇਦਾ ਹੋਵੇਗਾ ਤਾਂ ਜੋ ਉਹ ਭਵਿੱਖ ਵਿੱਚ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਆਰਥਿਕ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ ਜੇ ਉਹਨਾਂ ਨੂੰ ਹੱਥੀਂ ਕੰਮ ਕਰਨਾ ਆਉਂਦਾ ਹੋਵੇਗਾ ਤਾਂ ਉਹ ਖੁਦ ਸੂਟ ਸਟਿੱਚ ਕਰਕੇ ਪਾ ਸਕਣਗੀਆਂ ਅਤੇ ਆਪਣੇ ਪੈਸਿਆਂ ਦੀ ਬੱਚਤ ਵੀ ਕਰ ਸਕਣਗੀਆਂ ਧੰਨਵਾਦ